ਹੈਲੋ ਹਾਂਜੀ ਹਾਂਜੀ ਬਰਤਨਾਂ ਵਾਲੀ ਤੋਂ ਬੋਲਦੇ ਹਾਂ ਅੱਛਾ ਸਾਡੇ ਕੋਲੇ ਵੀ ਤੁਸੀਂ ਕਿਹੋ ਜਿਹਾ ਆਪਾਂ ਬਰਤਨ ਭਾਲਦੇ ਹਾਂ ਬਈ ਜਿਵੇਂ ਜੱਟਾਂ ਦੇ ਘਰਾਂ ਚ ਵਰਤਦੇ ਹਾਂ ਬਈ ਜਿਵੇਂ ਮੰਨ ਲਓ ਕੋਈ ਬਾਲਟੀ ਚਾਹੀਦੀ ਹੈ ਵੱਡੀ ਕੋਈ ਕੜਾਹੀ ਚਾਹੀਦੀ ਆ ਖੋਏ ਵਾਲੀ ਉਹ ਵੀ ਮਿਲ ਜੂਗੀ ਜ ਸਾਰਾ ਕੁਝ ਹੀ ਦੇਗੇ ਵੀ ਮਿਲ ਜਾਂਦੇ ਸਾਡੀ ਦੁਕਾਨ ਤੋਂ ਬਲਟੋਹੀਆਂ ਵੀ ਮਿਲ ਜਾਂਦੀਆਂ ਸਟੀਲ ਦੀਆਂ ਲੈ ਲਓ ਭਾਵੇਂ ਪਿੱਤਲ ਦੀਆਂ ਲੈ ਲਓ ਬਲਟੋਹੀਆਂ ਵੀ ਮਿਲਦੀਆਂ ਅੱਜ ਕੱਲ੍ਹ ਰਿੜਕਣੀ ਵੀ ਚਲਦੇ ਦੁੱਧ ਰਿੜਕਣ ਵਾਲੀ ਉਹ ਵੀ ਮਿਲ ਜਾਂਦੀ ਹੈ ਕੜਾਹੀ ਜਿਹੜੀ ਮਰਜ਼ੀ ਲੈ ਲਓ ਲੋਹੇ ਦੀ ਲੈਣੀ ਤਾਂ ਉਹ ਵੀ ਮਿਲ ਜਾਊਗੀ ਸਾਡੀ ਦੁਕਾਨ ਤੋਂ ਤਾਂ ਅਤੇ ਦੂਜੀ ਜੇ ਲੈਣੀ ਆ ਜਾਂ ਜੀ ਲੋਹੇ ਦੀ ਤਾਂ ਉਹ ਵੀ ਮਿਲ ਜੂਗੀ ਬਹੁਤ ਵਧੀਆ ਉਹ 'ਚ ਖੋਆ ਐਨ ਚਿੱਟਾ 'ਤੇ ਸਾਫ਼ ਬਣਦਾ ਬਹੁਤ ਸੋਹਣਾ ਖੋਆ ਹਾਂ ਅੱਛਾ ਸਟੀਲ ਦੀ ਲੈਣੀ ਹੈ ਬਈ ਢੱਕਣ ਵਾਲੀ ਕਿ ਪਿੱਤਲ ਦੀ ਲੈਣੀ ਹੈ ਅਤੇ ਖੁੱਲ੍ਹੀ ਤਾਂ ਸਟੀਲ ਦੀ ਮਿਲੂਗੀ ਪਿੱਤਲ ਦੀ ਤਾਂ ਥੋੜ੍ਹੀ ਜਿਹੀ ਬਾਲਟੀ ਲੰਮੀ ਹੁੰਦੀ ਆ ਅਤੇ ਥੱਲਿਉਂ ਭੀੜੀ ਹੁੰਦੀ ਉਤੋਂ ਖੁੱਲ੍ਹੀ ਹੁੰਦੀ ਆ ਕੜਾ ਬਣਿਆ ਹੁੰਦਾ ਪਿੱਤਲ ਦੀ ਜੇ ਤਾਂ ਸਟੀਲ ਦੀ ਦੇ ਨਹੀਂ ਕੜਾ ਹੁੰਦਾ ਹਾਂ ਇਹ ਵੇਖੀ ਨਾ ਮੰਨ ਲਓ ਜਿਹੜਾ ਲੋਹਾ ਲੋਹੇ ਦੇ ਵਿੱਚ ਖੋਆ ਥੋੜ੍ਹਾ ਜਿਹਾ ਲਾਲੀ ਜੀ 'ਚ ਬਣਦਾ ਜਿਵੇਂ ਲਾਲ ਹੋ ਜਾਂਦਾ ਕੜ ਕੜ ਕੇ ਦੁੱਧ ਅਤੇ ਜਿਹੜਾ ਚਿੱਟਾ ਲੈਂਦੇ ਆ ਆਪਾਂ ਜਾਜੀ ਲੋਹੇ ਦਾ ਉਹਦੇ ਵਿੱਚ ਖੋਆ ਸਾਫ਼ ਬਣਦਾ ਅਤੇ ਸੋਹਣਾ ਚਿੱਟਾ ਚਿੱਟਾ ਪ੍ਰੋਡਕਟ ਨਾਲ ਬਣਦਾ ਏ ਨਾ ਨਹੀਂ ਲੋਹੇ ਦਾ ਫਰਕ ਹੁੰਦਾ ਲੋਹਾ ਬਹੁਤ ਤਰ੍ਹਾਂ ਦਾ ਹੁੰਦਾ ਹਾਂ ਲੋਹਾ ਕਈ ਤਰ੍ਹਾਂ ਦਾ ਹੀ ਆ ਬਈ ਜਿਵੇਂ ਮੰਨ ਲਓ ਪਤੀਲੇ ਨਹੀਂ ਹੁੰਦੇ ਜਾਜੀ ਲੋਹੇ ਦੇ ਉਹ 'ਚ ਬਈ ਰੱਖਦੇ ਆ ਦੁਕਾਨਾਂ 'ਤੇ ਅਸੀਂ ਪਿੱਤਲ ਦੇ ਪਤੀਲੇ ਵੀ ਰੱਖਦੇ ਹਾਂ ਉਹ ਮਿਲ ਜਾਊਗਾ ਜਾਜੀ ਲੋਹੇ ਦਾ ਹਾਂ ਹਾਂ ਉਹ ਵੀ ਮਿਲ ਜਾਂਦਾ ਆ ਢੱਕਣ ਵੀ ਨਾਲ ਮਿਲੂਗਾ ਉਹ ਮਿਲਣਗੇ ਮੈਂ ਜ਼ਰੂਰ ਅਪੀਲ ਦੀਆਂ ਵੀ ਮਿਲਣਗੀਆਂ ਅਤੇ ਇਹ ਵੀ ਮਿਲਦੀਆਂ ਦੂਜੀਆਂ ਪਿੱਤਲ ਦੀਆਂ ਵੀ ਵੱਡੇ ਵੱਡੇ ਭਾਂਡੇ ਬਹੁਤ ਆਏ ਪਏ ਆ ਦੁਕਾਨ 'ਤੇ ਬਹੁਤ ਜ਼ਿਆਦੇ ਜਿਹੜਾ ਕੁਝ ਮਰਜ਼ੀ ਲੈ ਕੇ ਜਾਓ ਕੋਈ ਨਹੀਂ ਆ ਜਿਓ ਦੇਖਦੇ ਠੀਕ ਆ